ਸਾਡਾ ਜਿਹੜਾ ਪੇਂਡੂ ਇਲਾਕਾ ਹੈ ਇੱਥੇ ਵੱਡੇ ਹਸਪਤਾਲ ਨਹੀਂ ਹਨ ਸਾਨੂੰ ਇਲਾਜ ਕਰਵਾਉਣ ਲਈ ਸ਼ਹਿਰ ਹੀ ਜਾਣਾ ਪੈਂਦਾ ਹੈ ਪਰ ਜੇ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲਾਂ ਦੀ ਉਹ ਸਾਡੇ ਨੇੜੇ ਹੀ ਹਨ ਪਰ ਉੱਥੇ ਸਾਰੀਆਂ ਸੁਵਿਧਾਵਾਂ ਅ ਨਹੀਂ ਮਿਲਦੀਆਂ ਹਨ ਜਿਵੇਂ ਕਿ ਦੇਖਿਆ ਜਾਵੇ ਇੱਥੇ ਚੰਗੇ ਡਕਟਰ ਵੀ ਨਹੀਂ ਹਨ ਕਿਉਂਕਿ ਇੱਥੇ ਹਰ ਇੱਕ ਬਿਮਾਰੀ ਦਾ ਡੋਕਟਰ ਨਹੀਂ ਹੈ ਇੱਕ ਦੋ ਹੀ ਡੋਕਟਰ ਹਨ ਜੋ ਕਿ ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਦੇ ਇੱਥੇ ਹਾਈਜੀਨਿਕ ਵਾਰਡ ਵੀ ਨਹੀਂ ਹਨ ਨਾ ਹੀ ਲੋੜੀਂਦੇ ਬੈੱਡ ਹਨ ਆਕਸੀਜਨ ਵੀ ਬਹੁਤ ਘੱਟ ਹੈ ਇੱਥੇ ਦਵਾਈਆਂ ਵੀ ਬਹੁਤ ਘੱਟ ਹਨ ਕਿਉਂਕਿ ਇੱਥੇ ਸਾਰੇ ਹੀ ਇਲਾਜਾਂ ਦੇ ਡੋਕਟਰ ਨਹੀਂ ਹਨ ਇੱਥੇ ਬਹੁਤ ਹੀ ਘੱਟ ਜਿਹੜੀ ਹੈ ਸੁਵਿਧਾਵਾਂ ਪ੍ਰਾਪਤ ਹਨ ਇਸ ਕਰਕੇ ਸਾਨੂੰ ਜਿਹੜਾ ਇਹ ਆਪਣੇ ਹੋਰਾਂ ਇਲਾਜਾਂ ਲਈ ਜਿਹੜਾ ਕਿ ਸਾਨੂੰ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਪਰ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਹਨ ਸਾਨੂੰ ਇੱਥੇ ਵੀ ਜਿਹੜੀਆਂ ਮਿਲ ਸਕਦੀਆਂ ਹਨ ਜੇ ਸਰਕਾਰਾਂ ਇਹਨਾਂ ਵੱਲ ਧਿਆਨ ਦੇਣ ਸਾਨੂੰ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਮਿਲ ਸਕਦੀਆਂ ਹਨ ਜਿਵੇਂ ਕਿ ਇੱਥੇ ਚੰਗੇ ਡੋਕਟਰ ਆਉਣੇ ਚਾਹੀਦੇ ਹਨ ਹਾਈਜੀਨਿਕ ਵਾਰਡ ਜਿਹੜੇ ਆ ਉਹ ਬਣਨੇ ਚਾਹੀਦੇ ਹਨ ਜਿਹੜੇ ਬੈਡ ਆ ਉਹ ਆਉਣੇ ਚਾਹੀਦੇ ਹਨ ਆਕਸੀਜਨ ਦੀ ਜਿਹੜੀ ਘਾਟ ਆ ਉਹ ਪੂਰੀ ਕੀਤੀ ਜਾਣੀ ਚਾਹੀਦੀ ਹੈ ਜਿਹੜੀਆਂ ਦਵਾਈਆਂ ਦਾ ਜਿਹੜਾ ਲੈਵਲ ਆ ਉਹ ਵਧਾਉਣਾ ਚਾਹੀਦਾ ਹੈ ਅਤੇ ਜਿਹੜਾ ਵੀ ਹੋਰ ਸਾਜੋ ਸਮਾਨ ਹੈ ਆ ਉਹਦੇ ਵੱਲ ਸਾਰਾ ਸਾਨੂੰ ਧਿਆਨ ਦੇਣਾ ਚਾਹੀਦਾ ਹੈ